ਹਾਂਜੀ ਸਰ ਸਰ ਲਾਸਟ ਟਾਈਮ ਹਾਂਜੀ ਜੀ ਅਸੀਂ ਨਾ ਤੁਹਾਡੀ ਕੰਟੀਨ 'ਤੇ ਆਏ ਸੀ ਜੀ ਖਾਣਾ ਟਰਾਈ ਕੀਤਾ ਸੀ ਤੁਹਾਡਾ ਖਾਣਾ ਨਾ ਨਾ ਨਾ ਨੂਡਲ ਵਧੀਆ ਸੀ ਜੀ ਅਤੇ ਨਾ ਹੀ ਆਪਣੀ ਚਾਹ ਟਰਾਈ ਕੀਤੀ ਸੀ ਚਾਹ ਦੀ ਵੀ ਵ ਵਧੀਆ ਨਹੀਂ ਸੀ ਜੀ ਚਾਹ ਵੀ ਵਧੀਆ ਨਹੀਂ ਲੱਗੀ ਜੀ ਹਾਂਜੀ ਹਾਂਜੀ ਸਰ ਆਪਣੇ ਨਾ ਜੀ ਅਸੀਂ ਲਾਸਟ ਟਾਈਮ ਤੁਹਾਡੇ ਕੋਲ ਆਏ ਸੀ ਉਦੋਂ ਖਾਣਾ ਵੀ ਵਧੀਆ ਬਣਿਆ ਹੋਇਆ ਸੀ ਨੂਡਲਸ ਵੀ ਵਧੀਆ ਸੀ ਅਤੇ ਆਪਣੇ ਚਾਹ ਵੀ ਬਣਵਾਈ ਸੀ ਉਦੋਂ ਚਾਹ ਵੀ ਵਧੀਆ ਬਣੀ ਹੋਈ ਸੀ ਜੀ ਐਤਕੀ ਚਾਹ 'ਚ ਇੱਕ ਤਾਂ ਜੀ ਮਿੱਠਾ ਜ਼ਿਆਦਾ ਸੀ ਇੱਕ ਕਿਹਾ ਸੀ ਕਿ ਦੁੱਧ ਵਾਲੀ ਚਾਹ ਬਣਾਉਣੀ ਹੈ ਮਤਲਬ ਵਧੀਆ ਪਰ ਚਾਹ ਜੀ ਵਧੀਆ ਨਹੀਂ ਬਣ ਕੀ ਬਣੀ ਹੋਈ ਸੀ ਤਾਂ ਕਰਕੇ ਜੀ ਹੋ ਸਕੇ ਹੋ ਸਕਦਾ ਜੀ ਤੁਸੀਂ ਚਾਹ ਹੋ ਸਕਦਾ ਜੀ ਤੁਸੀਂ ਜਾਂ ਤਾਂ ਕੋਈ ਚੇਂਜ ਕੀਤਾ ਹੋਵੇ ਪ੍ਰੋਡਕਟ ਵਗੈਰਾ ਜੀ ਉਹਦੀ ਕੰਪਨੀ ਵਗੈਰਾ ਚੇਂਜ ਕੀਤੀ ਹੈ ਜਿਵੇਂ ਨੂਡਲ ਦੀ ਜੀ ਪਹਿਲੇ ਜੀ ਨੂਡਲ ਖਾਣ 'ਚ ਵਧੀਆ ਲੱਗਦੇ ਸੀ ਜੀ ਹੁਣ ਤੁਹਾਡੇ ਜਿਹੜੇ ਨੂਡਲ ਹੈ ਉਹਨਾਂ ਵਿੱਚ ਦਿੱਕਤ ਲੱਗ ਰਹੀ ਜਿਵੇਂ ਨਾ ਚਿੱਪ ਚਿੱਪੀ ਜਿਹੀ ਲੱਗ ਰਹੀ ਸੀ ਅਤੇ ਚਾਹ ਵੀ ਤੁਹਾਡੀ ਪੱਤੀ ਜੀ ਵਧੀਆ ਨਹੀਂ ਲੱਗ ਰਿਹਾ ਉਹਦਾ ਜਿਵੇਂ ਟੇਸਟ ਵਧੀਆ ਨਹੀਂ ਆ ਰਿਹਾ ਜੀ ਪੀਣ 'ਚ ਸਵਾਦ ਨਹੀਂ ਲੱਗ ਰਹੀ ਹਾਂਜੀ ਉਹ ਗੱਲ ਤਾਂ ਭਾਅ ਜੀ ਠੀਕ ਹੈ ਜੀ ਤੁਹਾਡੀ ਪਰ ਜੀ ਦੇਖੋ ਜੀ ਅੱਜ ਮੈਂ ਤੁਹਾਨੂੰ ਮੈਨੂੰ ਵਧੀਆ ਨਹੀਂ ਲੱਗ ਰਿਹਾ ਜੀ ਜੇ ਮੈਂ ਅੱਜ ਤੁਹਾਡੀ ਕਮ ਉਹਦਾ ਕਰ ਰਿਹਾ ਮਤਲਬ ਕੰਪਲੇਂਟ ਕਰ ਰਿਹਾ ਜੇ ਜਿਵੇਂ ਮੈਨੂੰ ਵਧੀਆ ਨਹੀਂ ਲੱਗਿਆ ਤਾਂ ਹੋਰ ਵੀ ਹੋਰ ਵੀ ਜੇ ਬੰਦੇ ਹੋਣਗੇ ਜੀ ਉਹਨਾਂ ਨੂੰ ਵੀ ਵਧੀਆ ਨਹੀਂ ਲੱਗਿਆ ਹੋਣਾ ਜੇ ਇਹਦੇ ਕਰਕੇ ਜੀ ਤੁਹਾਨੂੰ ਦਿੱਕਤ ਆਊਗੀ ਜੀ ਬਾਕੀ ਜੀ ਮੇਰੇ ਪੈਸੇ ਬਾਕੀ ਜੀ ਪੈਸੇ ਤੁਸ ਤੁਸੀਂ ਪੈਸੇ ਵੀ ਜ਼ਿਆਦਾ ਲਏ ਆ ਜੀ ਐਤਕੀ ਹਾਂਜੀ ਹਾਂਜੀ ਹਾਂਜੀ ਭਾਅ ਜੀ ਤੁਸੀਂ ਚੈੱਕ ਕਰੋ ਜੀ ਤੁਹਾਡੇ ਐਤਕੀ ਪੈਸੇ ਵੀ ਜ਼ਿਆਦਾ ਲੱਗੇ ਹੋਏ ਹੈ ਜੀ ਪਿਛਲੀ ਵਾਰੀ ਜੀ ਨੂਡਲ ਦੇ ਪੰਜਾਹ ਰੁਪਏ ਸੀ ਐਤਕੀ ਤੁਸੀਂ ਸੱਤਰ ਰੁਪਏ ਲਾਏ ਹੈ ਜੀ ਪਿਛਲੀ ਵਾਰੀ ਚਾਹ ਦਾ ਕੱਪ ਜੀ ਪੰਦਰ੍ਹਾਂ ਰੁਪਏ ਦਾ ਸੀ ਐਤਕੀ ਤੁਸੀਂ ਵੀਹ ਰੁਪਏ ਦਾ ਲਾਇਆ ਜੀ ਤੁਸੀਂ ਪੈਸੇ ਵੀ ਜ਼ਿਆਦਾ ਲੈ ਰਹੇ ਹੋ ਅਤੇ ਤੁਹਾਡੀ ਕੁਆਲਿਟੀ ਵੀ ਵਧੀਆ ਨਹੀਂ ਹੈਗੀ ਜੀ ਹਾਂਜੀ ਹਾਂਜੀ ਭਾਅ ਜੀ ਤੁਹਾਡੀ ਗੱਲ ਸਹੀ ਹੈ ਹਾਂਜੀ ਭਾਅ ਜੀ ਹੋ ਸਕਦਾ ਤੁਹਾਡੇ ਕੋਈ ਓਲਿੰਗ 'ਚ ਦਿੱਕਤ ਹੋਵੇ ਜਾਂ ਜਿਹਦੇ 'ਚ ਤੁਸੀਂ ਬਣਾ ਰਹੇ ਉਹਦੇ 'ਚ ਦਿੱਕਤ ਹੋਵੇ ਜਾਂ ਹੋ ਸਕਦਾ ਤੁਸੀਂ ਉਹ ਜਿਹੜੀ ਚੀਜ਼ ਮਸਾਲੇ ਵਗੈਰਾ ਯੂਜ਼ ਕੀਤੇ ਉਹਨਾਂ 'ਚ ਵੀ ਦਿੱਕਤ ਹੋ ਸਕਦੀ ਹੈ ਨਾ ਜੀ ਆਪਾਂ ਇਕੱਲੇ ਨੂਡਲ 'ਤੇ ਵੀ ਨਹੀਂ ਦੇ ਸਕਦੇ ਕਿ ਉਹ ਖਰਾਬ ਹੈ ਹੋ ਸਕਦਾ ਤੁਸੀਂ ਉਹਨੂੰ ਚੇਂਜ ਵਗੈਰਾ ਨਾ ਕੀਤਾ ਹੋਵੇ ਮਸਾਲੇ ਵਗੈਰਾ ਨਾ ਠੀਕ ਦੇਖੇ ਹੋਣ ਜੀ ਹੋ ਸਕਦਾ ਤੁਹਾਡੀ ਚਾਹ ਦਾ ਜਿਹੜਾ ਆਪਣਾ ਜੀ ਦੁੱਧ ਵਧੀਆ ਨਾ ਹੋਵੇ ਦੁੱਧ ਦੀ ਵੀ ਦਿੱਕਤ ਹੋ ਸਕਦੀ ਕਿਉਂਕਿ ਉਹਨੂੰ ਅਸੀਂ ਕਿਹਾ ਜੀ ਦੁੱਧ ਵਾਲੀ ਚਾਹ ਬਣਾਉਣੀ ਹੈ ਉਹਨੇ ਦੁੱਧ ਘੱਟ ਪਾਇਆ ਹੋ ਸਕਦਾ ਜੀ ਦੁੱਧ ਦੀ ਦਿੱਕਤ ਹੋਵੇ ਹਾਂਜੀ ਭਾਅ ਜੀ ਭਾਅ ਜੀ ਦੇਖੋ ਜੀ ਮੈਂ ਤਾਂ ਜੀ ਟੇਸਟ ਕੀਤਾ ਅਤੇ ਮੈਂ ਖਾ ਕੇ ਦੇਖਿਆ ਤਾਂ ਮੈਨੂੰ ਤਾਂ ਜੀ ਮੈਨੂੰ ਖਰਾਬ ਲੱਗਿਆ ਅੱਗੇ ਮੈਂ ਪਹਿਲੇ ਵੀ ਤੁਹਾਡੀ ਦੁ ਕੰਟੀਨ 'ਤੇ ਆਇਆ ਸੀ ਜੀ ਮੈਨੂੰ ਸਹੀ ਨਹੀਂ ਲੱਗੀ ਵਧੀਆ ਲੱਗੀ ਸੀ ਅਤੇ ਮੈਂ ਤਾਂ ਹੀ ਦੁਬਾਰਾ ਤੁਹਾਡੇ ਕੋਲ ਆਇਆਂ ਜੀ ਹੁਣ ਮੈਨੂੰ ਜੇ ਵਧੀਆ ਨਹੀਂ ਲੱਗੇਗਾ ਤਾਂ ਮੈਂ ਦੂਜੀ ਵਾਰੀ ਥੋੜ੍ਹੀ ਨਾ ਜੀ ਕਿਸੇ ਨੂੰ ਕਹੂੰਗਾ ਕਿ ਇੱਥੇ ਖਾਓ ਜਾਂ ਮੈਂ ਦੂਜੀ ਵਾਰੀ ਥੋੜ੍ਹੀ ਨਾ ਜੀ ਆਊਂਗਾ ਇੱਥੇ ਜਿਹੜਾ ਇਹ ਤਾਂ ਤੁਹਾਨੂੰ ਧਿਆਨ ਰੱਖਣਾ ਪਏਗਾ ਨਾ ਜੀ ਠੀਕ ਹੈ ਜੀ ਭਾਅ ਜੀ ਅੱਗੇ ਤੋਂ ਧਿਆਨ ਰੱਖਿਓ ਜੀ